ਪੰਜਾਬ ਵਿੱਚ ਬਹੁਤ ਸਾਰੇ ਰਿਆਇਤੀ ਕਿੱਤੇ ਹਨ ਪੰਜਾਬ ਵਿੱਚ ਸਭ ਤੋਂ ਵੱਧ ਖੇਤੀ ਕੀਤੀ ਜਾਂਦੀ ਹੈ ਅਤੇ ਕਿਸਾਨ ਪਹਿ ਪਿਛਲੇ ਸਮਿਆਂ ਵਿੱਚ ਬਾਹਰ ਹੱਲ ਰਾਹੀਂ ਖੇਤੀ ਬੀਜਦੇ ਸਨ ਅਤੇ ਉਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ ਅਤੇ ਉਸ ਉਹਨਾਂ ਦੀ ਐਨਰਜੀ ਬਹੁਤ ਘੱਟ ਜਾਂਦੀ ਹੈ ਅਤੇ ਉਹ ਆਹ ਖੇਤੀ ਕਰਦੇ ਸਮੇਂ ਉਹਨਾਂ ਨੂੰ ਬਹੁਤ ਹੀ ਸਮਾਂ ਲੱਗਦਾ ਹੈ ਅਤੇ ਅੱਜ ਕੱਲ੍ਹ ਦੇ ਸਮਿਆਂ ਵਿੱਚ ਬਹੁਤ ਹੀ ਮਸ਼ੀਨੀ ਰਾਹੀਂ ਖੇਤੀ ਕੀਤੀ ਜਾਂਦੀ ਹੈ ਜਿਵੇਂ ਕਿ ਟਰੈਕਟਰ ਹਾਰਡ ਟਰੈਕਟਰ ਹੱਲ ਹੜੰਬਾ ਰਾਹੀਂ ਕੀਤੀ ਜਾਂਦੀ ਹੈ ਅਤੇ ਵੀ ਹੁਣ ਵਿ ਹੁਣ ਵੀ ਹੁਣ ਦੇ ਸਮਿਆਂ ਵਿੱਚ ਕਿਸਾਨਾਂ ਨੂੰ ਬਹੁਤ ਘੱਟ ਮਿਹਨਤ ਕਰਨੀ ਪੈਂਦੀ ਹੈ ਅਤੇ ਜਿਵੇਂ ਕਿ ਪਹਿਲਾਂ ਉਹਨਾਂ ਨੂੰ ਬਹੁਤ ਹੀ ਜ਼ ਪਿਛਲੇ ਸਮੇਂ ਵਿੱਚ ਬਹੁਤ ਹੀ ਸਮਾਂ ਲੱਗਦਾ ਸੀ ਅਤੇ ਹੁਣ ਦੇ ਸਮਿਆਂ ਵਿੱਚ ਉਹਨਾਂ ਨੂੰ ਇੱਕ ਦੋ ਤਿੰਨ ਘੰਟਿਆਂ ਵਿੱਚ ਉਹ ਆਪਣੀ ਖੇਤੀ ਜ਼ਿਆਦਾ ਬੀਜ ਦਿੰਦੇ ਹਨ ਅਤੇ ਪਿਛਲੇ ਸਮਿਆਂ ਵਿੱਚ ਉਹ ਆਪਣੀ ਖੇਤੀ ਘੰ ਬਹੁਤ ਜ਼ਿਆਦਾ ਉਹਨਾਂ ਨੂੰ ਖੇਤੀ ਬੀਜਣ ਵਿੱਚ ਜ਼ਿਆਦਾ ਟੈਮ ਲੱਗਦਾ ਸੀ ਅਤੇ ਹੁਣ ਦੇ ਸਮਿਆਂ ਵਿੱਚ ਉਹ ਮਸ਼ੀਨੀ ਰਾਹੀਂ ਖੇਤੀ ਖੇਤੀ ਜਾ ਸੇ ਜਲਦੀ ਕਰ ਦਿੰਦੇ ਹਨ ਜਿਨ੍ਹਾਂ ਨਾਲ ਉਹਨਾਂ ਨੂੰ ਆਰਥਿਕ ਅਤੇ ਆਰਥਿਕ ਰਿਆਇਤੀ ਸਮ ਆਰਥਿਕ ਸਮੱਸਿਆ ਦਾ ਸਾਹਮਣਾ ਕਰਨਾ ਨਹੀਂ ਪੈਂਦਾ ਪਿਛਲੇ ਸਮਿਆਂ ਵਿੱਚ ਉਹਨਾਂ ਨੂੰ ਆਰਥਿਕ ਸਵਸਥ ਸਨਦਹਾ ਸਾਹਮਣਾ ਬਹੁਤ ਜ਼ਿਆਦਾ ਕਰਨਾ ਪੈ ਰਿਹਾ ਸੀ